ਹੈਲੋ ਤੁਸੀਂ ਏ ਬੀ ਬਿਊਟੀ ਸੈਲੂਨ ਤੋਂ ਬੋਲ ਰਹੇ ਹੋ ਮੈਮ ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਬੀ ਫੇਸ਼ੀਅਲਸ ਬਾਰੇ ਪੈਕ ਵਗੈਰਾ ਬਾਰੇ ਪੁੱਛਣਾ ਸੀ ਫੇਸ਼ੀਅਲਸ ਵਗੈਰਾ ਬਾਰੇ ਹਾਂਜੀ ਹਾਂਜੀ ਹਮ ਠੀਕ ਹੈ ਅਤੇ ਕੀ ਆਪਾਂ ਨੂੰ ਮਤਲਬ ਐਮ ਆਰ ਪੀ ਕੀ ਪੈ ਜਾਏਗੀ ਇਹਦੀ ਹਾਈਡਰਾ ਫੇਸ਼ੀਅਲ ਦੀ ਠੀਕ ਹੈ ਵੀ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜੋ ਫੇਸ ਦੇ ਉੱਤੇ ਗਲੋ ਹੈਗਾ ਉਹ ਉਸ ਟਾਈਮ 'ਤੇ ਆ ਜਾਵੇਗਾ ਜਦੋਂ ਆਪਾਂ ਫੇਸ਼ੀਅਲ ਵਗੈਰਾ ਕਰਵਾਵਾਂਗੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਵੀ ਅਗਰ ਆਪਾਂ ਜਿਵੇਂ ਹਾਈਡਰਾ ਫੇਸ਼ੀਅਲ ਕਰਵਾਵਾਂਗੇ ਤਾਂ ਆਪਾਂ ਨੂੰ ਉਹਦੇ 'ਤੇ ਕਿੰਨਾ ਡਿਸਕਾਊਂਟ ਮਿਲ ਸਕਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅਤੇ ਠੀਕ ਹੈ ਓਕੇ ਅਤੇ ਮੈਂ ਤੁਹਾਡੇ ਤੋਂ ਪੁੱਛਣਾ ਸੀ ਵੀ ਮੈਂ ਆਪਣੀ ਅਪੋਆਇੰਟਮੈਂਟ ਬੁੱਕ ਕਰਵਾਉਣਾ ਹੈਗਾ ਇਸ ਸੈਟਰਡੇ ਦੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਸ ਸੈਟਰਡੇ ਨੂੰ ਅਪੋਆਇੰਟਮੈਂਟ ਬੁੱਕ ਹੋ ਜਾਵੇਗੀ ਕਿ ਨਹੀਂ ਹਾਂਜੀ ਓਕੇ ਵੀ ਮਤਲਬ ਬਾਰ੍ਹਾਂ ਕੁ ਵਜੇ ਤੱਕ ਅਸੀਂ ਵ ਵੀ ਆ ਜਾਵਾਂਗੇ ਅਤੇ ਕਿੰਨੇ ਕੁ ਟਾਈਮ ਤੱਕ ਮਤਲਬ ਹੋ ਜਾਏਗਾ ਠੀਕ ਹੈ ਜੀ ਠੀਕ ਹੈ ਜੀ ਫਿਰ ਮੈਂ ਇਸ ਸੈਟਰਡੇ ਨੂੰ ਆਉਂਗੀ ਮੇਰੀ ਹਾਈਡਰਾ ਫੇਸ਼ੀਅਲ ਦੀ ਅਪੁਆਇੰਟਮੈਂਟ ਦੀ ਜਿਹੜੀ ਬੁੱਕ ਕਰਵਾ ਦੋਗੇ ਠੀਕ ਹੈ ਜੀ